ਬਾਇਓਗੈਸ ਪਲਾਂਟ ਲੋਕਾਂ ਦੀ ਮਦਦ ਦੇ ਨਾਲ ਨਾਲ ਸਾਰੀ ਸਾਡੀ ਆਲੇ ਦੁਆਲੇ ਸਾਡੇ ਵਾਤਾਵਰਨ ਦੀ ਮਦਦ ਵੀ ਕਰਦਾ ਸਮੁੱਚੀ ਜਿਹੜਾ ਸੱਚ ਸਮੁੱਚਾ ਭਾਈਚਾਰਾ ਨਾ ਸਾਰਿਆਂ ਦੀ ਮਦਦ ਕਰਦਾ ਹੈ ਕਿਉਂਕਿ ਬਾਇਓਗੈਸ ਪਲਾਂਟ ਵਿੱਚ ਜਿੰਨਾ ਵੀ ਅਸੀਂ ਸਾਰਾ ਸਾਡਾ ਕੂੜਾ ਕਰਕਟ ਹੁੰਦਾ ਹੈ ਉਸ ਨੂੰ ਉਸ ਵਿੱਚ ਅਸੀਂ ਪਾ ਸਕਦੇ ਹਾਂ ਉਸਦੇ ਪਾਉਣ ਨਾਲ ਕੀ ਹੁੰਦਾ ਹੈ ਇੱਕ ਤਾਂ ਸਾਡਾ ਵਾਤਾਵਰਨ ਜਿਹੜਾ ਉਹ ਸਾਫ਼ ਰਹਿੰਦਾ ਹੈ ਵਾਤਾਵਰਨ ਸਾਫ਼ ਰਹਿਣ ਨਾਲ ਸਾਡੇ ਜਿਹੜਾ ਆਲਾ ਦੁਆਲਾ ਸਾਫ਼ ਰਹੂਗਾ ਆਲਾ ਦੁਆਲਾ ਸਾਫ਼ ਰਹੂਗਾ ਅਤੇ ਸਾਡਾ ਜਿਹੜਾ ਭਾਈਚਾਰਾ ਆਲੇ ਦੁਆਲੇ ਰਹਿਣ ਵਾਲੇ ਲੋਕ ਆ ਉਹ ਬਿਮਾਰੀਆਂ ਤੋਂ ਬਚੇ ਰਹਿਣਗੇ ਜੇ ਬਿਮਾਰੀਆਂ ਤੋਂ ਬਚੇ ਰਹਿਣ ਨਾਲ ਜਿਸ ਨਾਲ ਇੱਕ ਤਾਂ ਸਾਡੇ ਹੈਲਥੀ ਵਾਤਾਵਰਨ ਬਣਦਾ ਹੈ ਤੰਦਰੁਸਤ ਵਾਤਵਰਨ ਦੀ ਉਪਜ ਹੋਵੇਗੀ ਉਸਦੇ ਨਾਲ ਦੇ ਨਾਲ ਜਿਹੜੀ ਸਾਡੀ ਹਵਾ ਹੈ ਸਮੁੱਚੀ ਹਵਾ ਉਹ ਸਾਫ਼ ਹੋਊਗੀ ਹਵਾ ਨਾਲ ਅਸੀਂ ਆਕਸੀਜਨ ਨਾਲ ਅਸੀਂ ਜਿਉਂਦੇ ਰਹਿ ਸਕਾਂਗੇ ਜੇਕਰ ਸਮੁ ਆਕਸੀਜਨ ਸ਼ੁੱਧ ਹੋਵੇਗੀ ਸ਼ੁੱਧ ਆਕਸੀਜਨ ਨਾਲ ਸਾਡਾ ਜਿਹੜਾ ਸਰੀਰ ਦਾ ਸਾਰਾ ਸ ਢਾਂਚਾ ਹੈ ਉਹ ਸਹੀ ਰਹਿੰਦਾ ਹੈ ਅਤੇ ਸਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਬਾਇਓਗੈਸ ਪਲਾਂਟ ਇੱਕ ਬਹੁਤ ਹੀ ਵਧੀਆ ਤਕਨੀਕ ਹੈ ਜਿਸ ਨਾਲ ਸਾਰਾ ਕੂੜਾ ਕਰਕਟ ਪਾ ਕੇ ਵਾਤਾਵਰਨ ਬਚਾਉਂਦੇ ਹੋਏ ਮਨੁੱਖ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਇਸ ਦੇ ਨਾਲ ਨਾਲ ਫਰੀ ਦਾ ਲਾਹਾ ਲੈ ਜਿਸ ਸਾਡੇ ਵਿੱਤੀ ਜਿਹੜੀ ਵਿੱਤੀ ਲੋੜਾਂ ਨੂੰ ਵੀ ਪੂਰਾ ਕਰਦਾ ਹੈ ਜਿਹੜੀਆਂ ਆਰਥਿਕ ਲੋੜਾਂ ਜਿਵੇਂ ਗੈਸ ਦੀ ਉਪਜ ਗੈਸ ਦੀ ਉਪਜ 'ਤੇ ਵੀ ਸਾਨੂੰ ਖਰਚਾ ਨਹੀਂ ਕਰਨਾ ਪੈਂਦਾ ਅਸੀਂ ਵਾਧੂ ਦਾ ਭੋਜਨ ਕੁਛ ਵੀ ਇਸ ਬਾਇਓਗੈਸ ਪਲਾਟ ਤੋਂ ਪੈਦਾ ਕੀਤੀ ਗੈਸ ਤੋਂ ਬਣਾ ਸਕਦੇ ਹਾਂ ਧੰਨਵਾਦ